ਵਿਗਿਆਨੀਆਂ ਦੁਆਰਾ ਮੰਨਿਆ ਜਾਂਦਾ ਹੈ ਕਿ ਧਰਤੀ ਜੋ ਕਿ ਇੱਕ ਗੈਸ ਦੇ ਗੋਲੇ ਤੋਂ ਠੰਡਾ ਹੋਣ ਤੋਂ ਬਾਅਦ ਬਣੀ ਉਹ ਮੰਨਦੇ ਹਨ ਕਿ ਕਿ ਧਰਤੀ ਔਰ ਸੂਰਜ ਪਹਿਲਾਂ ਕੁਛ ਵੀ ਨਹੀਂ ਸੀ ਹੁੰਦਾ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਕੀ ਅ ਕੀ ਸੀ ਕਿ ਧਰਤੀ ਇੱਕ ਬਹੁਤ ਛੋਟੇ ਜਿਹੇ ਗੋਲੇ ਦੇ ਵਿੱਚ ਸਿਮਟੀ ਹੋਈ ਸੀ ਸਾਰਾ ਬ੍ਰਹਿਮੰਡ ਉਸ ਗੋਲੇ ਦੇ ਵਿੱਚ ਸਿਮਟਿਆ ਹੋਇਆ ਸੀ ਕਈ ਕੁਛ ਅਣ ਪਛਾਣੇ ਕਾਰਨਾਂ ਕਾਰਨ ਉਹ ਗੋਲਾ ਬਹੁਤ ਹੀ ਜ਼ੋਰ ਨਾਲ ਫਟਿਆ ਜਿਹਨੂੰ ਅਸੀਂ ਬਿੱਗ ਬੈਂਗ ਬੋਲਦੇ ਹਾਂ ਉਸ ਤੋਂ ਬਾਅਦ ਕਿਆ ਹੋਇਆ ਕਿ ਜਿਹੜੇ ਪ ਛੋਟੇ ਛੋਟੇ ਅਣੂੰ ਸੀਗੇ ਉਹ ਇੱਕ ਦੂਜੇ ਨਾਲ ਜੁੜਦੇ ਗਏ ਅਤੇ ਉਹ ਬੜੇ ਵੱਡੇ ਵੱਡੇ ਅਣੂੰਆਂ ਵਿੱਚ ਅਤੇ ਚੀਜ਼ਾਂ ਵਿੱਚ ਬਦਲਦੇ ਗਏ ਔਰ ਜੋ ਕਿ ਉਹਨਾਂ ਗੈ ਉਹਨਾਂ ਨੇ ਬਹੁਤ ਸਾਰੀ ਗੈਸ ਦਾ ਇੱਕ ਗੋਲਾ ਬਣਾ ਲਿਆ ਉਹ ਗੈਸ ਦੇ ਗੋਲੇ ਦੇ ਮੱਧ ਵਿੱਚ ਠੰਡਾ ਹੋਣ ਦੇ ਨਾਲ ਹੌਲ਼ੀ ਹੌਲ਼ੀ ਕਿਆ ਹੋਇਆ ਸੂਰਜ ਉਪਜਿਆ ਸੂਰਜ ਦੇ ਉਪਜਣ ਤੋਂ ਬਾਅਦ ਸੂਰਜ ਦੇ ਆਲ਼ੇ ਦੁਆਲ਼ੇ ਦੇ ਅਣੂੰ ਆਪਸ ਵਿੱਚ ਜੁੜਦੇ ਗਏ ਜੁੜਨ ਦੇ ਨਾਲ ਉਹਨਾਂ ਨੇ ਜੁੜਨ ਤੋਂ ਬਾਅਦ ਛੋਟੇ ਛੋਟੇ ਗ੍ਰਹਿ ਬਣਾਉਣੇ ਸਟਾਰਟ ਕਰੇ ਉਹ ਗ੍ਰਹਿ ਲਗਾਤਾਰ ਇੱਕ ਦੂਜੇ ਨਾਲ ਟਕਰਾਉਂਦੇ ਰਹੇ ਅਤੇ ਉਹਨਾਂ ਦੇ ਟਕਰਾਉਣ ਦੇ ਨਾਲ ਬੜੇ ਬੜੇ ਗ੍ਰਹਿਆਂ ਦੀ ਉਤਪਤੀ ਹੋਈ ਉਹਨਾਂ ਦੀ ਉਤਪਤੀ ਤੋਂ ਬਾਅਦ ਅਤ ਆਪਣੀ ਧਰਤੀ ਜੋ ਕਿ ਪਹਿਲਾਂ ਪਿਘਲੀ ਹੋਈ ਸ ਅਵਸਥਾ ਵਿੱਚ ਸੀ ਉਹ ਹੌਲ਼ੀ ਹੌਲ਼ੀ ਠੰਡੀ ਹੁੰਦੀ ਗਈ ਅਤੇ ਠੰਡੀ ਹੋਣ ਦੇ ਨਾਲ ਅੱਜ ਦੇ ਰੂਪ ਵਿੱਚ ਪੁੱਜ ਗਈ